ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਇੱਛਾ ਰੱਖਦਾ ਹੈ ਅਤੇ ਉਸਨੂੰ ਪੂਰਾ ਕਰਨ ਦੇ ਲਈ ਉਹ ਜੀ ਤੋੜ ਮਿਹਨਤ ਵੀ ਲਗਾਉਂਦਾ ਹੈ ਇਸੇ ਪ੍ਰਕਾਰ ਨਾਲ ਮੇਰੀ ਵੀ ਇੱਕ ਇੱਛਾ ਹੈ ਕਿ ਮੈਂ ਇੱਕ ਕਿਤਾਬ ਲਿਖਾਂ ਜਿਹੜੀ ਦੁਨੀਆਂ ਦੇ ਵਿੱਚ ਪ੍ਰਚਲਿਤ ਹੋਵੇ ਇਸ ਕਿਤਾਬ ਨੂੰ ਲਿਖਣ ਲਈ ਮੈਂ ਜੀ ਤੋੜ ਮਿਹਨਤ ਕਰ ਰਿਹਾ ਕਈ ਕਈ ਵਾਰ ਕਈ ਕਈ ਘੰਟੇ ਤੱਕ ਬੈਠ ਕੇ ਮੈਂ ਕਿਤਾਬਾਂ ਪੜ੍ਹਦਾ ਹਾਂ ਕਈ ਕਈ ਥਾਵਾਂ 'ਤੇ ਜਾ ਕੇ ਰਿਸਰਚ ਵਰਕ ਕਰਦਾ ਹਾਂ ਗੂਗਲ ਬਹੁਤ ਸਹਾਈ ਹੈ ਉਸ ਤੋਂ ਵੀ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਆਪਣੇ ਦੋਸਤਾਂ ਮਿੱਤਰਾਂ ਮਾਂ ਬਾਪ ਕੋਲੋਂ ਵੀ ਮਦਦ ਲੈਂਦਾ ਹਾਂ ਇਸ ਕਿਤਾਬ ਨੂੰ ਲਿਖਣ ਦੇ ਲਈ ਕਈ ਕਈ ਵਾਰ ਤਾਂ ਮੈਂ ਕਈ ਥਾਵਾਂ 'ਤੇ ਜਾ ਕੇ ਉੱਥੋਂ ਦਾ ਇਤਿਹਾਸ ਫਰੋਲਦਾ ਹਾਂ ਜੋ ਮੇਰੀ ਕਿਤਾਬ ਨੂੰ ਪੂਰਨ ਕਰਨ ਵਿੱਚ ਸਹਾਈ ਹੋਵੇਗਾ ਮੈਂ ਇਹ ਕਿਤਾਬ ਕੁਝ ਤਰਕਾਂ ਦੇ ਨਾਲ ਲਿਖਣਾ ਚਾਹੁੰਦਾ ਹਾਂ ਤਾਂ ਕਿ ਇਹ ਕਿਤਾਬ ਜੋ ਵੀ ਕੋਈ ਪੜ੍ਹੇ ਉਸਨੂੰ ਸਮਝ ਆਵੇ ਕਿ ਇਹਦੇ ਵਿੱਚ ਕੁਛ ਫਜੂਲ ਗੱਲਾਂ ਨਹੀਂ ਲਿਖੀਆਂ ਹਨ ਮੈਂ ਚਾਹੁੰਦਾ ਹਾਂ ਕਿ ਇਹ ਕਿਤਾਬ ਪੂਰੀ ਦੁਨੀਆਂ ਦੇ ਵਿੱਚ ਫੇਮਸ ਹੋਵੇ ਇਸ ਲਈ ਇਸਨੂੰ ਬੜੇ ਹੀ ਧਿਆਨ ਦੇ ਨਾਲ ਅਤੇ ਬੜੀ ਹੀ ਮਿਹਨਤ ਦੇ ਨਾਲ ਤਿਆਰ ਕਰ ਰਿਹਾ ਧੰਨਵਾਦ